ਹਾਂ ਕੁਲਦੀਪ ਬਾਈ ਕੀ ਹਾਲ ਆ ਠੀਕ ਠੀਕ ਵਧੀਆ ਹਾਂ ਹਾਂ ਵਧੀਆ ਵਧੀਆ ਆਪਣੀ ਸੁਣਾ ਬਸ ਕੰਮ ਧੰਦੇ ਹੀ ਲੱਗੇ ਹੋਏ ਸੀ ਯਾਰ ਕਣਕ ਕੁਣਕ ਤੋਂ ਵਿਹਲੇ ਹੁਣ ਹੋਏ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਆਪਣਾ ਦੱਸ ਚਲੋ ਵਧੀਆ ਫਿਰ ਤਾਂ ਚ ਹੁਣ ਸੋਚਦੇ ਸੀ ਯਾਰ ਝੋਨੇ ਦੀ ਪਨੀਰੀ ਦਾ ਮੈਂ ਕਿਹਾ ਸਲਾਹ ਲੈ ਲਈਏ ਸਲਾਹ ਲੈ ਲਈਏ ਮੈਂ ਕਿਹਾ ਕਿਹੜੀ ਬੀਜੀ ਬੀ ਲਾਈਏ ਪਨੀਰੀ ਹੂੰ ਹੂੰ ਅੱਛਾ ਹੂੰ ਹੂੰ ਹੂੰ ਹੂੰ ਹਾਂ ਹਾਂ ਬਾਨ ਪਾਣੀ ਇੱਕ ਨੰਬਰ ਆ ਬਾਨ ਚੰਗੇ ਵਧੀਆ ਤੱਸੀ ਦਾ ਪਾਣੀ ਵਧੀਆ ਲੱਗਦਾ

ਹੂੰ ਹੂੰ ਠੀਕ ਹੈ ਊਂ ਝਾੜ ਚੰਗਾ ਇਹਦਾ ਠੀਕ ਹੈ ਇਹ ਕੁਛ ਕੁ ਬਾਣ ਹਾਂ ਸੀਗੀ ਮੱਕੀ ਦੀ ਵੀ ਯਾਰ ਕਿੱਲੇ ਕੁ ਦੀ ਲਾ ਲੈਂਦੇ ਕਿੱਲੇ ਦੋ ਕਿੱਲਿਆਂ 'ਚ ਇੱਕ ਵਾਰੀ ਹੂੰ ਹੂੰ ਹਾਂ ਹਾਂ ਠੀਕ ਹੈ ਮੱਕੀ ਤੋਂ ਬਾਅਦ ਵਧੀਆ ਹੋ ਜਾਂਦਾ ਉਹ ਠੀਕ ਐ ਫਿਰ ਲਾ ਲਈਏ ਨਾ ਦੋ ਕੁ ਕਿੱਲੇ ਮੱਕੀ ਹੂੰ ਹਾਂ ਬਸ ਇੱਕ ਅੱਧੀ ਵਰਾਇਟੀ ਕੋਈ ਚੰਗੀ ਜਿਹੀ ਆਪਾਂ ਉਹ ਕਰ ਲੈਦੇ ਹਾਂ ਹੂੰ ਹੂੰ ਠੀਕ ਹੈ ਚਲੋ ਬਸ ਫਿਰ ਕਰਦੇ ਹਾਂ ਤਿਆਰੀ ਝੋਨੇ ਦੀ ਹੁਣ ਠੀ ਹਾਂ ਹਾਂ ਹਾਂ ਹੋਰ ਵਧੀਆ ਵਧੀਆ ਵੀਰੇ